ਮੇਰੀ ਹਰ ਸਮੇਂ ਦੀ ਮਨਪਸੰਦ ਗੇਮ ਮਾਈਨਕ੍ਰਾਫਟ ਹੈ ਇਹ ਗੇਮ ਬਹੁਤ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਅਤੇ ਇਸ ਵਿੱਚ ਸਮੇਂ ਸਮੇਂ 'ਤੇ ਅਪਡੇਟ ਰਾਹੀਂ ਨਵੇਂ ਨਵੇਂ ਫੀਚਰ ਵੀ ਆਉਂਦੇ ਰਹਿੰਦੇ ਹਨ ਜਿਸ ਨਾਲ਼ ਇਸ ਨੂੰ ਖੇਡਣ ਵਾਲੇ ਖਿਡਾਰੀਆਂ ਦੀ ਰੁਚੀ ਬਣੀ ਰਹੇ ਇਹ ਗੇਮ ਚੀਨ ਦੀ ਇੱਕ ਕੰਪਨੀ ਮੌਜੰਗ ਗੇਮਿੰਗ ਦੁਆਰਾ ਬਣਾਈ ਗਈ ਹੈ ਇਸ ਇਹ ਗੇਮ ਸਿੰਗਲ ਪਲੇਅਰ ਅਤੇ ਮਲਟੀਪਲੇਅਰ ਦੋਨਾਂ ਤਰੀਕਿਆਂ ਨਾਲ਼ ਖੇਡੀ ਜਾ ਸਕਦੀ ਹੈ ਇਹ ਗੇਮ ਇੱਕ ਓਪਨ ਵਰਲਡ ਕਿਸਮ ਦੀ ਗੇਮ ਹੈ ਮੈਂ ਆਪਣੇ ਦੋਸਤਾਂ ਨਾਲ਼ ਮਲਟੀਪਲੇਅਰ ਮੋਡ ਵਿੱਚ ਇਸ ਗੇਮ ਨੂੰ ਖੇਡਣਾ ਜ਼ਿਆਦਾ ਪਸੰਦ ਕਰਦਾ ਹਾਂ ਅਸੀਂ ਇਸ ਗੇਮ ਵਿੱਚ ਆਲੇ ਦੁਆਲੇ ਤੋਂ ਚੀਜ਼ਾਂ ਜਿਵੇਂ ਕਿ ਲੱਕੜ ਪੱਥਰ ਕੋਲਾ ਆਦਿ ਇਕੱਠਾ ਕਰਕੇ ਇਸ ਵਿੱਚ ਸਰਵਾਈਵ ਕਰਨਾ ਹੁੰਦਾ ਹੈ ਅਤੇ ਇਸ ਵਿੱਚ ਅਸੀਂ ਕੁਝ ਵੀ ਬਣਾ ਸਕਦੇ ਹਾਂ ਜਿਵੇਂ ਕਿ ਔਜ਼ਾਰ ਕੁਹਾੜੀ ਤਲਵਾਰ ਤੀਰ ਕਮਾਨ ਖਾਣਾ ਕੱਪੜੇ ਆਦਿ ਇਸ ਵਿੱਚ ਅਸੀਂ ਛੋਟੇ ਘਰ ਤੋਂ ਲੈ ਕੇ ਵੱਡੇ ਵੱਡੇ ਮਹਿਲ ਵੀ ਬਣਾ ਸਕਦੇ ਹਾਂ ਇਸ ਖੇਡ ਵਿੱਚ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ਼ ਰਲ਼ ਕੇ ਸ਼ਰਾਰਤਾਂ ਕਰਨ ਵਿੱਚ ਵੀ ਬਹੁਤ ਆਨੰਦ ਆਉਂਦਾ ਹੈ ਇਹ ਗੇਮ ਮੋਬਾਇਲ ਅਤੇ ਕੰਪਿਊਟਰ ਦੋਨਾਂ ਦੇ ਲਈ ਉਪਲਬਧ ਹੈ ਇਹ ਗੇਮ ਨਵੀਂ ਤਕਨੀਕ ਦੇ ਨਾਲ਼ ਵੀ ਆਰ ਗਲਾਸਿਸ ਦੇ ਵਿੱਚ ਵੀ ਖੇਡੀ ਜਾ ਸਕਦੀ ਹੈ ਜਿਸ ਨਾਲ਼ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਇਸ ਗੇਮ ਦੇ ਅੰਦਰ ਵੜ ਕੇ ਇਸ ਨੂੰ ਅਨੁਭਵ ਕਰ ਰਹੇ ਹੋਵੇ ਇਸ ਨੂੰ ਵੀ ਆਰ ਵਿੱਚ ਖੇਡਣ ਨਾਲ ਇਸਦੇ ਕੰਟਰੋਲਰ ਵਿੱਚੋਂ ਬਹੁਤ ਵਧੀਆ ਵਾਈਵਰੇਸ਼ਨ ਵੀ ਹੁੰਦੀਆਂ ਹਨ ਜਿਸ ਨਾਲ਼ ਖੇਡਣ ਦਾ ਅਨੁਭਵ ਹੋਰ ਵਧੀਆ ਹੋ ਜਾਂਦਾ ਹੈ